ਸਭ ਤੋਂ ਪਹਿਲਾਂ ਉੱਠਣਾ ਅਤੇ ਇਸ਼ਨਾਨ ਕਰਨਾ ਬੁਰਸ਼ ਕਰਨਾ ਅਤੇ ਗੁਰਬਾਣੀ ਸੁਣਨੀ ਸੁਣਨ ਵਿੱਚ ਮੇਰਾ ਸਭ ਤੋਂ ਜ਼ਿਆਦਾ ਧਿਆਨ ਗੁਰਬਾਣੀ ਸੁਣਨ 'ਚ ਹੈ ਗੁਰਦੁਆਰਾ ਸਾਹਿਬ ਜ਼ਰੂਰ ਜਾਈ ਦਾ ਅਤੇ ਉਸ ਦੇ ਬਾਅਦ ਮੇਰਾ ਅਖਬਾਰ ਪੜ੍ਹਨ ਦਾ ਬਹੁਤ ਸ਼ੌਂਕ ਹੈ ਅਤੇ ਉਸ ਤੋਂ ਬਾਅਦ ਵਿੱਚ ਬੱਚਿਆਂ ਦਾ ਖਾਣਾ ਬਣਾਉਣਾ ਫਿਰ ਘਰ ਦੀ ਸਫਾਈ ਕਰਨਾ ਉਸ ਤੋਂ ਬਾਅਦ ਵਿੱਚ ਸਬਜ਼ੀ ਬਣਾਉਣਾ ਫਿਰ ਆਪਣਾ ਸਿਲਾਈ ਕਢਾਈ ਦਾ ਕੰਮ ਕਰਨਾ ਮੈਂ ਸਲਵਾਰ ਸੂਟ ਵੀ ਬਣਾਉਂਦੀ ਹਾਂ ਪਲਾਜ਼ੋ ਪੈਂਟ ਪਜਾਮਾ ਸੂਟ 'ਤੇ ਲੈਸਾਂ ਵੀ ਲਗਾਉਂਦੀ ਹਾਂ ਇੰਟਰਲੋਕ ਵੀ ਕਰਦੀ ਹਾਂ ਪੀਕੋ ਵੀ ਕਰਦੀ ਹਾਂ ਦੁਪਹਿਰ ਨੂੰ ਮੈਂ ਆਰਾਮ ਵੀ ਕਰਦੀ ਹਾਂ ਬੱਚਿਆਂ ਵਾਸਤੇ ਟੀ ਵੀ ਲਗਾ ਕੇ ਦਿੰਦੀ ਹਾਂ ਸ਼ਾਮ ਨੂੰ ਚਾਰ ਵਜੇ ਅਸੀਂ ਸਾਰੇ ਇਕੱਠੇ ਚਾਹ ਪੀਂਦੇ ਹਾਂ ਉਸ ਤੋਂ ਬਾਅਦ ਵਿੱਚ ਮੈਂ ਸ਼ਾਮ ਨੂੰ ਆਪਣੀ ਸਹੇਲੀ ਨਾਲ਼ ਸੈਰ ਕਰਨ ਵੀ ਜਾਂਦੀ ਹਾਂ ਸੈਰ ਤੋਂ ਬਾਅਦ ਫਿਰ ਗੁਰਦੁਆਰੇ ਜਾਂਦੀ ਹਾਂ ਸ਼ਾਮ ਦਾ ਖਾਣਾ ਮੇਰੀ ਨੂੰਹ ਬਣਾਉਂਦੀ ਹੈ ਅਸੀਂ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਇਕੱਠੇ ਬੈਠ ਕੇ ਤਾਂ ਅਤੇ ਆਪਣਾ ਦੁੱਖ ਸੁੱਖ ਸਾਂਝਾ ਕਰਦੇ ਹਾਂ ਉਸ ਤੋਂ ਬਾਅਦ ਵਿੱਚ ਸੌਂ ਜਾਈ ਦਾ